ਨਿਊਜ਼ ਮੀਡੀਆ ਨੇ ਹਰ ਇੱਕ ਫੀਲਡ ਵਿੱਚ ਬਹੁਤ ਵਧੀਆ ਭੂਮਿਕਾ ਨਿਭਾਈ ਹੈ ਮੀਡੀਆ ਚੈਨਲ ਵਾਲੇ ਵੱਖ ਵੱਖ ਧਰਮ ਦੇ ਰੀਤੀ ਰਿਵਾਜ਼ਾਂ ਦੀ ਵੀ ਵੀਡੀਓ ਅਪਲੋਡ ਕਰਦੇ ਹਨ ਜਿਨ੍ਹਾਂ ਨਾਲ ਸਾਡੇ ਗਿਆਨ ਵਿੱਚ ਵੀ ਵਾਧਾ ਹੁੰਦਾ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਸਾਨੂੰ ਸਮਝ ਆਈ ਕਿ ਹ ਕਿ ਹਰ ਇੱਕ ਧਰਮਾਂ ਵਿੱਚ ਪਰਮਾਤਮਾ ਬਾਰੇ ਦੱਸਿਆ ਜਾਂਦਾ ਹੈ ਅਤੇ ਸਾਨੂੰ ਸਭ ਧਰਮਾਂ ਦਾ ਸਤਿਕਾਰ ਵੀ ਕਰਨਾ ਚਾਹੀਦਾ ਹੈ ਅਤੇ ਸਾਨੂੰ ਵੱਖ ਵੱਖ ਗੁਰਦੁਆਰੇ ਅਤੇ ਮੰਦਰਾਂ ਬਾਰੇ ਵੀ ਪਤਾ ਲੱਗਦਾ ਹੈ ਨਿਊਜ਼ ਮੀਡੀਆ ਵਿੱਚ ਦੇਖ ਕੇ ਹੀ ਅਸੀਂ ਕਈ ਗੁਰਦੁਆਰੇ ਗੁਰਸਥਾਨਾਂ ਦੇ ਦਰਸ਼ਨ ਕੀਤੇ ਹਨ ਜਿਵੇਂ ਬਾਬਾ ਦੀਪ ਸਿੰਘ ਜੀ ਬਾਰੇ ਵੀ ਜਿਹੜੇ ਨਿਊਜ਼ ਮੀਡੀਆ ਵਾਲੇ ਨੇ ਬਹੁਤ ਇਹਨਾਂ ਦੀ ਪ੍ਰਮੋਸ਼ਨ ਕਰਦੇ ਆ ਅਤੇ ਲੋਕਾਂ ਦੇ ਵਿੱਚ ਜਾ ਜਾ ਕੇ ਉਹਨਾਂ ਤੋਂ ਵੀ ਸਵਾਲ ਪੁੱਛਦੇ ਨੇ ਵੀ ਤੁਹਾਨੂੰ ਬਾਬਾ ਦੀਪ ਸਿੰਘ ਗੁਰਦੁਆਰੇ ਆਉਣ ਨਾਲ ਕੀ ਲਾਭ ਹੁੰਦਾ ਕਈ ਤੁਹਾਡੀ ਮਨੋਕਾਮਨਾ ਪੂਰੀ ਹੋਈ ਹੈ ਅਤੇ ਲੋਕ ਸਾਰੇ ਆਪਣੇ ਜਿਹੜੇ ਜੋ ਜੋ ਉਹਨਾਂ ਦੀਆਂ ਮੰਨਤਾਂ ਪੂਰੀਆਂ ਹੁੰਦੀਆਂ ਨੇ ਮੀਡੀਆ ਨੂੰ ਦੱਸਦੇ ਹਨ ਕਿ ਸਾਡੇ ਕਈ ਤਾਂ ਰੋਗ ਦੁੱਖ ਦੂਰ ਹੋਏ ਨੇ ਸਾਡੇ ਬੱਚੇ ਦੇਸ਼ਾਂ ਵਿਦੇਸ਼ਾਂ ਵਿੱਚ ਬਾਬਾ ਜੀ ਦੀ ਕਿਰਪਾ ਨਾਲ ਗਏ ਨੇ ਨਿਊਜ਼ ਮੀਡੀਆ ਵਾਲੇ ਅਤੇ ਲੋਕਾਂ ਨੂੰ ਵੀ ਜਾਗਰਤ ਕਰਦੇ ਹਨ ਅਤੇ ਹੋਰ ਲੋਕਾਂ ਦੇ ਵਿੱਚ ਵੀ ਵਿਸ਼ਵਾਸ ਪੈਦਾ ਕਰਦੇ ਹਨ ਕਿ ਅਸੀਂ ਵੀ ਉਸ ਗੁਰਦੁਆਰੇ ਜਾਈਏ ਅਤੇ ਸਾਡੇ ਵੀ ਮਨ ਦੀ ਮਨੋਕਾਮਨਾ ਪੂਰੀ ਹੋਵੇ ਅਤੇ ਸਾਨੂੰ ਬਾਬਾ ਦੀਪ ਸਿੰਘ ਗੁਰਦੁਆਰੇ ਵਿੱਚ ਬਹੁਤ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਲੋਕਾਂ ਦੀਆਂ ਬਹੁਤ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਅਤੇ ਲੋਕਾਂ ਨੂੰ ਬਹੁਤ ਵਿਸ਼ਵਾਸ ਦੇ ਨਾਲ ਉੱਥੇ ਦਰਸ਼ਨ ਕਰਦੇ ਹਨ ਅਤੇ ਸਾਨੂੰ ਵੀ ਉਹਨਾਂ ਦਰਸ਼ਨਾਂ ਨਾਲ ਸਾਨੂੰ ਬਹੁਤ ਮਨ ਨੂੰ ਸ਼ਾਂਤੀ ਮਿਲਦੀ ਹੈ